ਜਦੋਂ ਵੀ ਸਾਨੂੰ ਆਪਣੇ ਖੇਤਾਂ ਵਿੱਚ ਜ਼ਰੂਰਤ ਹੁੰਦੀ ਹੈ ਅਸੀਂ ਆਪਣੇ ਭਾਈਚਾਰੇ ਨਾਲ ਗੱਲ ਕਰਦੇ ਹਾਂ ਉਹਨਾਂ ਨੂੰ ਬੁਲਾਉਂਦੇ ਹਨ ਅਤੇ ਉਹ ਆ ਜਾਂਦੇ ਹਨ ਅਤੇ ਅਸੀਂ ਆਪ ਸਾਡੇ ਪਿੰਡ ਦੀ ਸੱਥ ਹੈ ਉੱਥੇ ਅਸੀਂ ਉਹਨਾਂ ਨੂੰ ਆਪਣੇ ਘਰ ਖੇਤੀਬਾੜੀ ਬਾਰੇ ਸਾਰਾ ਕੁਛ ਦੱਸਦੇ ਰਹਿੰਦੇ ਹਨ ਵੀ ਅਸੀਂ ਆਪਣੇ ਖੇਤਾਂ ਵਿੱਚ ਇਹ ਫਸਲ ਬੋਈ ਹੈ ਅਤੇ ਇਸ ਦਾ ਇਹ ਨਤੀਜਾ ਨਿਕਲਿਆ ਹੈ ਅਸੀਂ ਆਪਸੀ ਉੱਥੇ ਸੱਥ ਵਿੱਚ ਬੈਠ ਕੇ ਗੱਲਾਂ ਕਰਦੇ ਰਹਿੰਦੇ ਹਨ ਅਤੇ ਜੇ ਕਿਸੀ ਭਾਈ ਨੂੰ ਲੋੜ ਹੁੰਦੀ ਹੈ ਅਸੀਂ ਉਸ ਦੀ ਮਦਦ ਲਈ ਉਹਦੇ ਖੇਤਾਂ ਵਿੱਚ ਪਹੁੰਚ ਜਾਂਦੇ ਹਨ